ਜੀ ਹਾਂ ਮੈਂ ਪਹਾੜ ਟੁੱਟਣ ਦੀ ਸਥਿਤੀ ਦਾ ਸਾਹਮਣਾ ਕੀਤਾ ਹੋਇਆ ਹੈ ਅਤੇ ਇਸ ਤੋਂ ਮੈਂ ਆਪਣਾ ਕਿਵੇਂ ਬਚਾਅ ਕੀਤਾ ਮੈਂ ਉਹ ਅੱਜ ਤੁਹਾਨੂੰ ਦੱਸਾਂਗਾ ਮੈਂ ਕੁੱਲੂ ਦੇ ਰਸਤੇ ਵਿੱਚ ਹਿਮਾਲਿਆ ਦੀਆਂ ਪਹਾੜੀਆਂ 'ਤੇ ਟਰੈਕਿੰਗ ਕਰਨ ਗਿਆ ਸੀ ਅਤੇ ਨਵੰਬਰ ਦਾ ਮਹੀਨਾ ਸੀ ਬਰਫ ਹਾਲੇ ਪੈਣੀ ਸ਼ੁਰੂ ਹੀ ਹੋਈ ਸੀ ਅਤੇ ਮੈਂ ਪਹਾੜੀ ਉੱਤੇ ਚੜ੍ਹਦਾ ਸੀ ਅਤੇ ਮੈਨੂੰ ਪਿੱਛੋਂ ਦੀ ਕੁਝ ਤਰੇੜੀਆਂ ਦੀ ਆਵਾਜ਼ ਆਈ ਜਿਵੇਂ ਕਿ ਕੁਝ ਟੁੱਟ ਰਿਹਾ ਹੋਵੇ ਤਾਂ ਮੈਂ ਦੇਖਿਆ ਕਿ ਪਹਾੜ ਦੀ ਹਲਕੀ ਜਿਹੀ ਚਟਾਨ ਟੁੱਟ ਰਹੀ ਸੀ ਅਤੇ ਉਸਨੂੰ ਮੈਂ ਲੈਂਡ ਸਲਾਈਡ ਮੰਨਿਆ ਅਤੇ ਮੈਂ ਉਸ ਤੋਂ ਡਰਿਆ ਨਹੀਂ ਬਲਕਿ ਮੈਂ ਉਸ ਨਾਲ ਆਪਣੇ ਆਪ ਨੂੰ ਬਚਾਅ ਲਈ ਅਲੱਗ ਅਲੱਗ ਤਰ੍ਹਾਂ ਦੇ ਤਰੀਕੇ ਸੋਚਣ ਲੱਗ ਪਿਆ ਜਿਵੇਂ ਕਿ ਮੈਂ ਘਬਰਾਇਆ ਨਹੀਂ ਅਤੇ ਮੈਂ ਫਟਾਫਟ ਇੱਕ ਅਜਿਹੀ ਥਾਂ 'ਤੇ ਗਿਆ ਜੋ ਕਿ ਥੋੜ੍ਹੀ ਪਲੇਨ ਹੋਵੇ ਜਿਸ ਕਾਰਨ ਮੈਂ ਆਪਣਾ ਜਿਹੜਾ ਕਿ ਬੈਲੈਂਸ ਨਾ ਵਿਗਾੜਾਂ ਅਤੇ ਮੈਂ ਚੱਲ ਸਕਾਂ ਅਤੇ ਜਦੋਂ ਹਲਕੀ ਜਿਹੀ ਚਟਾਨ ਡਿੱਗੀ ਤਾਂ ਮੈਨੂੰ ਕੋਈ ਅਜਿਹਾ ਡਰ ਨਹੀਂ ਸੀ ਕਿ ਮੈਂ ਗਿਰਾਗਾ ਕਿਉਂਕਿ ਮੈਂ ਬਿਲਕੁਲ ਸਹੀ ਦਿਸ਼ਾ ਵੱਲ ਜਾ ਰਿਹਾ ਸੀ ਅਤੇ ਮੈਂ ਉਹ ਪਲੇਨ ਰਸਤੇ 'ਤੇ ਖੜ੍ਹਾ ਹੋ ਗਿਆ ਜਦੋਂ ਪੂਰੀ ਚਟਾਨ ਡਿੱਗ ਗਈ ਤਾਂ ਮੈਂ ਅੱਗੇ ਵਧਿਆ ਅਤੇ ਮੈਂ ਥੱਲੇ ਆ ਗਿਆ ਜਿਸ ਨਾਲ ਮੇਰਾ ਬਚਾਅ ਬਹੁਤ ਹੀ ਚੰਗੇ ਤਰੀਕੇ ਨਾਲ ਹੋਇਆ